ਹਾਂਜੀ ਜਦੋਂ ਅਸੀਂ ਆਪਣੀਆਂ ਜਮੀਨਾਂ ਖਰੀਦਦੇ ਅਤੇ ਵੇਚਦੇ ਹਨ ਤਾਂ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਸਮੱਸਿਆ ਆਉਂਦੀਆਂ ਹਨ ਜਿਵੇਂ ਕਿ ਇੰਤਕਾਲ ਕਰਾਉਣਾ ਪਟਵਾਰੀ ਜੀ ਕੋਲ਼ ਜਾਣਾ ਤਹਿਸੀਲਦਾਰ ਕੋਲ਼ ਜਾਣਾ ਅਤੇ ਹੋਰ ਰਜਿਸਟਰੀ ਵਗੈਰਾ ਕਰਾਉਣੀਆਂ ਬਹੁਤ ਪਰੇਸ਼ਾਨੀ ਹੁੰਦੀ ਆ ਸਾਨੂੰ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਪਰੇਸ਼ਾਨੀਆਂ ਨਾਲ਼ ਘਿਰਨਾ ਪੈਂਦਾ ਹੈ